ਮੈਨੂੰ ਪੰਛੀਆਂ 'ਚੋਂ ਸਭ ਤੋਂ ਵੱਧ ਜਿਹੜੇ ਮਨਮੋਹਕ ਅਤੇ ਸੁੰਦਰ ਆਕਰਸ਼ਕ ਪੰਛੀ ਹਨ ਉਹ ਹਨ ਤੋਤਾ ਅਤੇ ਮੋਰ ਤੋਤਾ ਅਤੇ ਮੋਰ ਇੱਕ ਅਜਿਹੇ ਪੰਛੀ ਹਨ ਜਿਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੋਤੇ ਦੀ ਚਹਿ ਚਹਾਹਟ ਬਹੁਤ ਹੀ ਖੂਬਸੂਰਤ ਲੱਗਦੀ ਹੈ ਜਦੋਂ ਉਹ ਉੱਡ ਕੇ ਕਿਤੇ ਜਾ ਕੇ ਫਿਰ ਵਾਪਿਸ ਆਉਂਦਾ ਹੈ ਚੀਕਦਾ ਚਿਲਾਉਂਦਾ ਆਉਂਦਾ ਹੈ ਕਿਤਨੀ ਖੁਸ਼ੀ ਨਾਲ ਆਉਂਦਾ ਹੈ ਅਤੇ ਦੂਸਰਾ ਮੋਰ ਮੋਰ ਇਤਨਾ ਚੰਗਾ ਲੱਗਦਾ ਹੈ ਜਦੋਂ ਉਹ ਪੈਲਾਂ ਪਾਉਂਦਾ ਹੈ ਖੁਸ਼ੀ ਨਾਲ ਝੂਮਦਾ ਹੈ ਅਤੇ ਉਸ ਦੇ ਨਾਲ ਮੋਰਨੀ ਵੀ ਝੂਮਦੀ ਹੈ ਅਤੇ ਜਿਸ ਨੂੰ ਦੇਖ ਕੇ ਅੰਦਰ ਅਥਾਹ ਖੁਸ਼ੀ ਹੁੰਦੀ ਹੈ ਸਾਡੇ ਅੰਦਰ ਬਹੁਤ ਜ਼ਿਆਦਾ ਪ੍ਰਸੰਨਤਾ ਹੁੰਦੀ ਹੈ ਖੁਸ਼ੀ ਹੁੰਦੀ ਹੈ ਤੋਤੇ ਦਾ ਸਾਨੂੰ ਰੰਗ ਬਹੁਤ ਪਸੰਦ ਲੱਗਦਾ ਹੈ ਉਸ ਦਾ ਹਰਾ ਰੰਗ ਵੈਸੇ ਹੀ ਬਹੁਤ ਆਕਰਸ਼ਿਤ ਕਰਦਾ ਹੈ ਇਵੇਂ ਹੀ ਜੋ ਮੋਰ ਹੈ ਉਸ ਦੇ ਰੰਗ ਬਿਰੰਗੇ ਪੰ ਪੰਖ ਉਹ ਸਾਨੂੰ ਬਹੁਤ ਹੀ ਵਧੀਆ ਲੱਗਦੇ ਹਨ ਸਾਨੂੰ ਆਕਰਸ਼ਿਤ ਕਰਦੇ ਹਨ ਕਿਉਂਕਿ ਅਸੀਂ ਇਹਨਾਂ ਨੂੰ ਇੱਕ ਪਵਿੱਤਰ ਪੰਛੀ ਮੰਨਦੇ ਹੋਏ ਮੰਦਿਰ ਅਤੇ ਗੁਰਦੁਆਰੇ ਵਿੱਚ ਵੀ ਰੱਖਦੇ ਹਾਂ ਕਿਉਂਕਿ ਇਹਨਾਂ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਨੂੰ ਪਾਕ ਪਵਿੱਤਰ ਮੰਨਿਆ ਜਾਂਦਾ ਹੈ ਮੋਰ ਦੇ ਪੰਖਾਂ ਨੂੰ ਉਹਨਾਂ ਦੀਆਂ ਪੱਖੀਆਂ ਨੂੰ ਅਸੀਂ ਮੰਦਿਰ ਅਤੇ ਮਸਜਿਦ ਅਤੇ ਗੁਰਦੁਆਰੇ ਵਿੱਚ ਵੀ ਦੇਖਦੇ ਹਾਂ ਮੈਂ ਜੋ ਤੋਤੇ ਹੈ ਹਨ ਉਹਨਾਂ ਨੂੰ ਆਮ ਤੌਰ 'ਤੇ ਦਰੱਖਤਾਂ 'ਤੇ ਬਣੇ ਹੋਏ ਖੁੱਡ ਵਿੱਚ ਬੈਠਦੇ ਹੋਏ ਦੇਖਦਾ ਹਾਂ ਜਾਂ ਕਿਸੇ ਟਾਹਲੀ ਦੇ ਦਰੱਖਤ ਦੇ ਉੱਤੇ ਬੈਠਾ ਹੋਇਆ ਦੇਖਦਾ ਹਾਂ ਇੰਝ ਹੀ ਮੈਂ ਮੋਰ ਕਿਸੇ ਬਾਗ ਵਿੱਚ ਦੇਖੇ ਹਨ ਇਕ ਸਾਡੇ ਘਰ ਦੇ ਸਾਹਮਣੇ ਬਹੁਤ ਵੱਡਾ ਬਾਗ ਸੀ ਉੱਥੇ ਬਹੁਤ ਸਾਰੇ ਮੋਰ ਰਹਿੰਦੇ ਸਨ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਸੀ ਸਾਡਾ ਸਾਰਾ ਪਰਿਵਾਰ ਉਹਨਾਂ ਨੂੰ ਦੇਖਿਆ ਕਰਦਾ ਸੀ